ਹਾਂਜੀ ਅਸੀਂ ਆਪਣੇ ਰਿਕੋਡ ਕਾਇਮ ਕਰ ਸਕਦੇ ਹਾਂ ਪਰ ਅੱਜ ਕੱਲ੍ਹ ਦੇ ਟਾਈਮ ਵਿੱਚ ਜੋ ਵੇਟਰ ਨੇ ਜਾਂ ਰੈਸਟੋਰੈਂਟ ਦੇ ਹੋਰ ਕਰਮਚਾਰੀ ਨੇ ਉਹ ਇਹਨਾਂ ਦਾ ਇਹਨੂੰ ਬਹੁਤ ਔਖੀ ਤਰ੍ਹਾਂ ਮੰਨਦੇ ਨੇ ਜਿਵੇਂ ਕਿ ਹੁਣ ਵੇਟਰ ਆ ਵੇਟਰ ਇੱਕ ਕੰਪਲੇਂਟ ਆ ਰਹੀ ਆ ਆਪਾਂ ਨੂੰ ਵੀ ਵੇਟਰ ਪ੍ਰੋਪਰ ਆਪਣੀ ਯੂਨੀਫਾਰਮ 'ਚ ਨਹੀ ਆ ਗਲੱਬਜ਼ ਨਹੀਂ ਆ ਸਿਰ 'ਤੇ ਕੈਪ ਨਹੀਂ ਹੈ ਔਰ ਜੋ ਵੀ ਆਪਾਂ ਉਹਨਾਂ ਦਾ ਔਡਰ ਕਰਦੇ ਹਾਂ ਉਹ ਬਹੁਤ ਸਲੋਅ ਔਰ ਲੰਬੇ ਸਮੇਂ ਲਈ ਆ ਰਿਹਾ ਹੈਗਾ ਦੂਜੀ ਕੰਪਲੇਂਟ ਅੱਜ ਕੱਲ੍ਹ ਮੇਨ ਇਹ ਆ ਰਹੀ ਆ ਵੀ ਖਾਣੇ ਦੀ ਸਫਾਈ ਨਹੀਂ ਹੈਗੀ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਗੰਦਾ ਮੰਦਾ ਆ ਰਿਹਾ ਸਫਾਈ ਮਤਲਬ ਪ੍ਰੋਪਰ ਸਬਜ਼ੀ ਧੋਤੀ ਨਹੀਂ ਹੁੰਦੀ ਅੱਜ ਕੱਲ੍ਹ ਕੀੜੇ ਮਕੌੜੇ ਇੰਨੇ ਜ਼ਿਆਦਾ ਆ ਰਹੇ ਨੇ ਕੁਛ ਆਪਾਂ ਵਿਆਹਾਂ ਦੇ ਵਿੱਚ ਵੀ ਇਹ ਚੀਜ਼ਾਂ ਦੇਖ ਰਹੇ ਹਾਂ ਵੀ ਐਨਾ ਜ਼ਿਆਦਾ ਸੋਸ਼ਲ ਮੀਡੀਆ 'ਤੇ ਆ ਰਿਹਾ ਵੀ ਪ੍ਰੋਪਰ ਸਫਾਈ ਦਾ ਨਹੀਂ ਹੋ ਰਿਹਾ ਲੋਕ ਰੌਲਾ ਪਾਉਂਦੇ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਉਹ ਪ੍ਰੋਪਰ ਜਾ ਕੇ ਸਫਾਈ ਨਹੀਂ ਕਰਦੇ ਕੁਛ ਦਿਨ ਰੌਲਾ ਪੈਂਦਾ ਆ ਉਸ ਤੋਂ ਬਾਅਦ ਫਿਰ ਉਹੀ ਚੀਜ਼ਾਂ ਸੇਮ ਆ ਜਾਂਦੀਆਂ ਇਵੇਂ ਹੀ ਰੈਸਟੋਰੈਂਟ ਵਿੱਚ ਆ ਕੁਛ ਦਿਨ ਪਹਿਲਾਂ ਦੀ ਹੀ ਗੱਲ ਆ ਸਾਡੇ ਨੇੜੇ ਨਜ਼ਦੀਕ ਲੱਗਦੇ ਇੱਕ ਰੈਸਟੋਰੈਂਟ ਦੇ ਵਿੱਚ ਸਬਜ਼ੀ ਦੇ ਵਿੱਚ ਕੁਛ ਕੀੜੇ ਪਾਏ ਗਏ ਇੱਕ ਦੋ ਅਤੇ ਜਦੋਂ ਉਹਨਾਂ ਨੂੰ ਕਿਹਾ ਉਹਨਾਂ ਨੇ ਆਪਣੀ ਪੂਰੀ ਸ ਦੀ ਪੂਰੀ ਸਫਾਈ ਦਿੱਤੀ ਵੀ ਸਾਡਾ ਐਵੇਂ ਨਹੀਂ ਐਵੇਂ ਕਰਕੇ ਅਸੀਂ ਆਹ ਕਰਦੇ ਹਾਂ ਆਹ ਕਰਦੇ ਹਾਂ ਪਰ ਉਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ ਹੈਗੀ ਇਸ ਕਰਕੇ ਉਹ ਕਾਰਵਾਈ ਦੇ ਪੂਰੇ ਬਣਦੇ ਨੇ ਵੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਐਵੇਂ ਇਹਨਾਂ ਨੂੰ ਕੋਈ ਵੀ ਅਸਰ ਨਹੀਂ ਹੁੰਦਾ ਹੈਗਾ ਲੋਕਾਂ ਦੀ ਜਾਨ ਨਾਲ ਇਹ ਖਿਲਵਾੜ ਕਰਦੇ ਨੇ ਜਿੰਨੀ ਜਾਨ ਦੇ ਨਾਲ ਖਿਲਵਾੜ ਕਰਦੇ ਨੇ ਓਨਾ ਇਹ ਕਿਉਂਕਿ ਅੱਜ ਕੱਲ੍ਹ ਐਨਾ ਬਿਜ਼ੀ ਹੋ ਗਿਆ ਲੋਕ ਸੰਡੇ ਸੈਚਰਡੇ ਨੂੰ ਆਪਣਾ ਘੁੰਮਣ ਫਿਰਨ ਜਾਂਦੇ ਨੇ ਚਲੋ ਬਾਹਰ ਖਾਣਾ ਖਾ ਆਉਂਦੇ ਇਸ ਕਰਕੇ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦਾ ਰਿਕੋਡ ਵੀ ਕਾਇਮ ਰੱਖਣਾ ਚਾਹੀਦਾ ਤਾਂ ਕਿ ਇਹ ਅੱਗੇ ਤੋਂ ਕਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਗਲਤੀ ਨਾ ਕਰ ਸਕਣ